ਇੱਕ ਸਿੰਗਲਪੁਰੀ ਤਰ੍ਹਾਂ ਸੈਟ ਕਰਨ ਵਾਲੇ ਹੋਏ ਹੋਵਣ ਕਾਲ ਨੂੰ ਕੋਈ ਦੇਖਣ ਵੇਖਣਾ ਇੱਕ ਮਨੁੱਖ ਲਈ ਦੁੱਖ ਦੁੱਖ ਮਿਲੇਗਾ ਇਹਨਾਂ ਵਿੱਚੋਂ ਦੋ ਦੋ ਨੂੰ ਦੇਖ ਕੇ ਖੁਸ਼ੀ ਖੁਸ਼ੀ ਮਿਲੇਗੀ ਅੱਠ ਨੂੰ ਇਕੱਠੇ ਵੇਖ ਕੇ ਚਿੱਠੀ ਮਿਲੇਗੀ ਹਿੰਦੂ ਧਰਮ ਵਿੱਚ ਇੱਕ ਅੰਧ ਵਿਸ਼ਵਾਸੀ ਵਿਸ਼ਵਾਸ ਹੈ ਕਿ ਜੇਕਰ ਅਸੀਂ ਇੱਕ ਮੋਰ ਜਾਂ ਜਾਂ ਖੰਭ ਪ੍ਰਾਪਤ ਕਰ ਸਕਦੇ ਹਾਂ ਤਾਂ ਸਕਦੇ ਹਾਂ ਅਤੇ ਇਸ ਨੂੰ ਇੱਕ ਕਿਤਾਬ ਵਿੱਚ ਰੱਖ ਸਕਦੇ ਹਾਂ ਤਾਂ ਸਾਨੂੰ ਬਹੁਤ ਸਾਰਾ ਗਿਆਨ ਸਿੱਖਣ ਨੂੰ ਮਿਲੇਗਾ ਅਤੇ ਇੱਕ ਵਿਦਿਆਰਥੀ ਇੱਕ ਹੁਸ਼ਿਆਰ ਬਾਬੇ ਬੱਚਾ ਬਣ ਜਾਵੇਗਾ ਅਤੇ ਉਹ ਆਪਣੀ ਪੜ੍ਹਾਈ ਦੌਰਾਨ ਉੱਚੇ ਅੰਕ ਅਤੇ ਗ੍ਰੇਡ ਪ੍ਰਾਪਤ ਕਰੇਗਾ ਵਿੱਦਿਆ ਮੈਂ ਵਿੱਦਿਆ ਮੈਂ ਖੁਸ਼ ਖੁਦ ਕੋਸ਼ਿਸ਼ ਕੀਤੀ ਕੀਤੀ ਕੀਤੀ ਪਰ ਮੈਂ ਬੁਰੀ ਤਰ੍ਹਾਂ ਗਲਤ ਸਾਬਤ ਹੋਇਆ